ਢਾਡੀ ਪਰੰਪਰਾ ਇੱਕ ਮਹੱਤਵਪੂਰਨ ਅਤੇ ਪੁਰਾਣੀ ਵਿਰਸਾ ਹੈ ਜੋ ਮੁਖ ਤੌਰ 'ਤੇ ਆਦੀ ਕਵਿਤਾ ਅਤੇ ਭਾਵਨਾਵਾਂ ਨੂੰ ਪ੍ਰਗਟ ਕਰਨ ਦਾ ਇੱਕ ਤਰੀਕਾ ਹੈ ਢਾਡੀ ਪਰੰਪਰਾ ਵਿੱਚ ਵਿਸ਼ੇਸ਼ ਤੌਰ 'ਤੇ ਲੋਕ ਜ਼ਿੰਦਗੀ ਦੇ ਤਜੁਰਬੇ ਸਾਂਝੀ ਸਮਾਜਿਕ ਅਤੇ ਰਾਜਨੀਤਿਕ ਸਥਿਤੀਆਂ ਪ੍ਰੇਮ ਅਤੇ ਵਿਛੋੜੇ ਵਿਧਾ ਅਤੇ ਮਾਨਵਤਾ ਦੇ ਮੁੱਦੇ ਲਏ ਜਾਂਦੇ ਹਨ ਇਸ ਦਾ ਮਕਸਦ ਲੋਕਾਂ ਨੂੰ ਸੰਵੇਦਨਸ਼ੀਲ ਅਤੇ ਰੂਹਾਨੀ ਤੌਰ 'ਤੇ ਜੁੜਨਾ ਹੈ ਕਿਸੇ ਸਮੇਂ 'ਤੇ ਢਾਡੀ ਗਾਇਕੀ ਨੂੰ ਰਾਜਨੀਤਿਕ ਅਤੇ ਸਮਾਜਿਕ ਸੰਘਰਸ਼ਾਂ ਦੇ ਪ੍ਰਗਟਾਵੇ ਅਤੇ ਵਿਸ਼ੇਸ਼ ਤੌਰ 'ਤੇ ਸਿੱਖ ਇਤਿਹਾਸ ਦੇ ਮੁੱਦੇ ਵੀ ਅੱਗੇ ਲਿਆਏ ਗਏ ਇਹ ਗਾਇਕੀ ਸੰਗੀਤਕ ਅੰਦਾਜ ਬੋਲ ਬਾਲ ਦੀ ਬੋਲੀ ਅਤੇ ਇਨਸਾਨੀ ਅਨੁਭਵਾਂ ਨੂੰ ਪ੍ਰਗਟ ਕਰਨ ਲਈ ਖਾਸ ਤੌਰ 'ਤੇ ਵਰਤੀ ਜਾਂਦੀ ਹੈ ਇਸ ਲਈ ਆਮ ਤੌਰ 'ਤੇ ਮੁੱਖ ਵਿਸ਼ੇ ਸ਼ਾਮਿਲ ਹੁੰਦੇ ਹਨ ਪ੍ਰੇਮ ਅਤੇ ਵਿਛੋੜਾ ਖਾਸ ਕਰਕੇ ਰੋਮਾਂਟਿਕ ਪ੍ਰੇਮ ਕਹਾਣੀਆਂ ਵਿੱਚ ਓਦਿਆਂ ਨਾਲ ਸੰਬੰਧਿਤ ਗੀਤ ਗਾਏ ਜਾਂਦੇ ਹਨ ਸੋ ਢਾਡੀ ਗਾਇਕੀ ਪੰਜਾਬੀ ਸੰਗੀਤ ਅਤੇ ਸੰਸਕਾਰ ਦਾ ਇੱਕ ਅਹਿਮ ਕਾ ਪੂਰਮ ਹਿੱਸਾ ਹੈ